ਹੈਲੋ ਹਾਂਜੀ ਤੁਸੀਂ ਟੂਰਿਸਟਰ ਬੋਲਦੇ ਹੋ ਨਾ ਹੈਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾ ਹਾਂਜੀ ਸਰ ਇਸ ਟਾਈਮ ਮੌਸਮ ਹੈਗਾ ਵਧੀਆ ਠੰਡ ਵਾਲਾ ਮੌਸਮ ਆ ਧੁੰਦਾਂ ਜਿਉਂ ਜਿਉਂ ਮੌਸਮ ਆਈ ਜਾਣਾ ਮਤਲਬ ਦਿਨ ਆਈ ਜਾਦੇ ਆ ਤਾਂ ਉਰੇ ਧੁੰਦਾਂ ਬਹੁਤ ਜ਼ਿਆਦਾ ਪੈਦੀਆਂ ਅਤੇ ਤੁਸੀਂ ਬਾਕੀ ਇਹ ਵੀ ਜਦੋਂ ਸਤਾਈ ਅਠਾਈ ਤਰੀਕ ਆਵੇਗੀ ਦਸੰਬਰ ਦੀ ਤਾਂ ਇਹਦੇ ਵਿੱਚ ਸਾਡੇ ਇੱਥੇ ਸ਼ਹੀਦੀ ਜੋੜ ਮੇਲਾ ਵੀ ਲੱਗਦਾ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਸ ਨੂੰ ਦੇਖਣ ਲਈ ਦੁਨੀਆਂ ਬਹੁਤ ਦੂਰ ਦੂਰ ਤੋਂ ਆਉਂਦੀ ਆ ਅਤੇ ਤੁਸੀਂ ਬਾਕੀ ਦਾ ਤੁਸੀਂ ਕਦੋਂ ਆਉਣਾ ਵੈਸੇ ਟਾਇਮ ਟਾਇਮ ਨਾਲ ਮੌਸਮ ਚੇਂਜ ਹੁੰਦਾ ਰਹਿੰਦਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ ਸਰ ਤੁਸੀਂ ਹਾਂਜੀ ਸਰ ਤੁਸੀਂ ਆ ਸਕਦੇ ਇਸ ਮੌਸਮ 'ਚ ਆ ਸਕਦੇ ਹੋ ਅਤੇ ਇੱਕ ਤਾਂ ਮੌਸਮ ਵਧੀਆ ਹੋਵੇਗਾ ਦੂਜਾ ਤੁਹਾਨੂੰ ਘੁੰਮਣ ਲਈ ਵੀ ਜਗ੍ਹਾ ਵਾਧੂ ਆ ਅਤੇ ਬਾਕੀ ਸਾਡੇ ਜਿਹੜਾ ਸਤਾਈ ਅਠਾਈ ਦਸੰਬਰ ਨੂੰ ਸ਼ਹੀਦੀ ਜੋੜ ਮੇਲਾ ਉਹਦੇ ਵਿੱਚ ਵੀ ਤੁਹਾਡਾ ਪੂਰਾ ਪਰਿਵਾਰ ਆ ਕੇ ਬਹੁਤ ਜ਼ਿਆਦਾ ਖੁਸ਼ ਹੋਵੇਗਾ ਬਹੁਤ ਧਾਰਮਿਕ ਜਗ੍ਹਾ ਅਤੇ ਮਨ ਨੂੰ ਬਹੁਤ ਜ਼ਿਆਦਾ ਸਕੂਨ ਮਿਲਦਾ ਜੇਕਰ ਆਪਾਂ ਹੈ ਨਾ ਇਥੇ ਘੁੰਮਦੇ ਆ ਬਾਕੀ ਘੁੰਮਣ ਨੂੰ ਵੀ ਜਗ੍ਹਾ ਮੌਸਮ ਵੀ ਵਧੀਆ ਹੁੰਦਾ ਰਹਿਣ ਸਹਿਣ ਦਾ ਸਾਰਾ ਬਹੁਤ ਜ਼ਿਆਦਾ ਵਧੀਆ ਹੁੰਦਾ ਹਾਂਜੀ ਸਰ ਅੱਗੇ ਤੁਸੀਂ ਆ ਸਕਦੇ ਹੋ ਜਨਵਰੀ ਫਰਵਰੀ ਮਾਰਚ ਤੱਕ ਮੌਸਮ ਜ਼ਿਆਦਾ ਵਧੀਆ ਹੁੰਦਾ ਜਿਵੇਂ ਦਾ ਤੁਹਾਨੂੰ ਇਨਵਾਇਰਮੈਂਟ ਚਾਹੀਦਾ ਉਵੇਂ ਦਾ ਬਹੁਤ ਜ਼ਿਆਦਾ ਵਧੀਆ ਮਿਲੇਗਾ ਜਨਵਰੀ ਹੋਰ ਵਿਚ ਆ ਕੇ ਆ ਜਾਂਦਾ ਹੋ ਜਾਂਦਾ ਵੀ ਜਿਵੇਂ ਬਸੰਤ ਆ ਜਾਂਦੀ ਆ ਤਾਂ ਮੌਸਮ ਹੋਰ ਵੀ ਜ਼ਿਆਦਾ ਵਧੀਆ ਨਿੱਖਰ ਜਾਂਦਾ ਮੌਸਮ

ਠੀਕ ਹੈ ਠੀਕ ਹੈ ਸਰ ਠੀਕ ਹੈ ਜੀ